ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਓਲਾ ਐਪ ਤੋਂ ਸਰ ਮੈਂ ਤੁਹਾਡੀ ਕੈਬ ਦਾ ਨੰਬਰ ਲਿਆ ਸੀ ਅਤੇ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀਗੀ ਮੈਂ ਐਕਚੁਲੀ ਪਟਿਆਲਾ ਜਾਣਾ ਸੀਗਾ ਮੇਰਾ ਉੱਥੇ ਇੰਟਰਵਿਊ ਹੈਗਾ ਠੀਕ ਹੈ ਅਤੇ ਮੈਨੂੰ ਮੀਨਜ਼ ਉਹਨਾਂ ਨੇ ਟਾਈਮਿੰਗ ਦਿੱਤੀ ਸੀਗੀ ਵੀ ਅਸੀਂ ਸਹੀ ਸਾਢੇ ਨੌਂ ਤੁਹਾਡੇ ਕੋਲ ਪਹੁੰਚ ਜਾਂਗੇ ਬਟ ਹਜੇ ਤੱਕ ਕੋਈ ਆਇਆ ਨਹੀਂ ਹੈਗਾ ਗਾ ਨੌਂ ਚਾਲੀ ਹੋ ਗਏ ਹੈ ਠੀਕ ਹੈ ਅਤੇ ਤੁਸੀਂ ਸਮਝਦੇ ਹੀ ਇਸ ਗੱਲ ਨੂੰ ਜਦੋਂ ਆਪਾਂ ਨੂੰ ਕੰਮ ਹੁੰਦਾ ਗਾ ਜਾਣਾ ਹੁੰਦਾ ਤਾਂ ਉਦੋਂ ਇਹ ਚੀਜ਼ ਹੈਗੀ ਬਹੁਤ ਹੀ ਮੀਨਜ਼ ਉਹ ਲੱਗਦਾ ਹੈਗਾ ਵੀ ਛੇਤੀ ਉਹ ਚੀਜ਼ ਮਿਲ ਜਾਵੇ ਅਤੇ ਕੈਬ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਚੱਲੀ ਹੋਈ ਹੈ ਤਾਂ ਵੀ ਵਧੀਆ ਹੈਗੀ ਹੈ ਵੀ ਚੱਲੋ ਜਲਦੀ ਪਹੁੰਚ ਜਾਂਦੇ ਹਾਂ ਵਧੀਆ ਗੱਡੀ ਹੈਗੀ ਹੈ ਠੀਕ ਹੈ ਉੱਥੇ ਪਹੁੰਚਣਾ ਆਸਾਨ ਹੈ ਚੱਲੋ ਔਨਲਾਈਨ ਬੁਕਿੰਗ ਕੀਤੀ ਅਤੇ ਆਪਣਾ ਤੁਸੀਂ ਚੱਲੇ ਗਏ ਠੀਕ ਹੈ ਪਰ ਮੈਨੂੰ ਹੁਣ ਤੁਸੀਂ ਦੇਖ ਲਓ ਇੰਨਾ ਟਾਈਮ ਹੋ ਰਿਹਾ ਮੈਨੂੰ ਨਹੀਂ ਦਿੱਕਤ ਹੋ ਰਹੀ ਹੈ ਮੈਨੂੰ ਇਹ ਹੀ ਹੈ ਵੀ ਮੈਂ ਆਪਣੇ ਟਾਈਮ 'ਤੇ ਪਹੁੰਚ ਜਾ ਠੀਕ ਹੈ ਇੰਨੀ ਦੂਰ ਜਾਣਾ ਹੈਗਾ ਗਾ ਠੀਕ ਹੈ ਮੇਰਾ ਇੰਟਰਵਿਊ ਹੈਗਾ ਗਾ ਅਤੇ ਉੱਥੇ ਜਾ ਕੇ ਵੀ ਮੈਨੂੰ ਥੋੜ੍ਹੀ ਬਹੁਤ ਰੈਸਟ ਦੀ ਵੀ ਜ਼ਰੂਰਤ ਹੋਵੇਗੀ ਮੈਂ ਉੱਥੇ ਪਹੁੰਚੂਗੀ ਟਾਈਮ ਨਾਲ ਠੀਕ ਹੈ ਖਾਣਾ ਵਗੈਰਾ ਖਾਣਾ ਹੋਰ ਵੀ ਥੋੜ੍ਹਾ ਬਹੁਤ ਆਉਂਦਾ ਹੁੰਦਾ ਹੈ ਕੰਮ ਠੀਕ ਹੈ ਇਸ ਲਈ ਪਲੀਜ਼ ਮੇਰੀ ਰਿਕੁਐਸਟ ਹੈਗੀ ਐਗੀ ਵੀ ਤੁਸੀਂ ਜਲਦੀ ਤੋਂ ਜਲਦੀ ਭਿਜਵਾ ਦਿਓ ਜ਼ਿਆਦਾ ਟਾਈਮ ਨਾ ਲਗਾਓ ਤੁਹਾਨੂੰ ਵੀ ਪਤਾ ਠੀਕ ਹੈ ਇੰਨਾ ਟਾਈਮ ਨਹੀਂ ਉਹ ਹੁੰਦੀ ਹੈਗੀ ਠੀਕ ਹੈ ਜੇ ਮੀਨਜ਼ ਆਪਾਂ ਕੈਬ ਦਾ ਜੋ ਹੈਗਾ ਇੰਨਾ ਟਾਈਮ ਵੇਟ ਹੀ ਕਰਨੀ ਹੈ ਤਾਂ ਆਪਾਂ ਆਪਣੇ ਘਰ ਦਾ ਵਹੀਕਲ ਹੀ ਲੈ ਜਾਂਗੇ ਠੀਕ ਹੈ ਇਸ ਲਈ ਕਰਵਾਈ ਹੈ ਨਾ ਵੀ ਚੱਲੋ ਇੱਕ ਤਾਂ ਸਹੀ ਕੰਫਰਟੇਬਲ ਰਹਿੰਦੇ ਹਾਂ ਆਪਾਂ ਇਹਦੇ ਵਿੱਚ ਠੀਕ ਹੈ ਦੂਰ ਦਾ ਸਫ਼ਰ ਹੈ ਜਾਣਾ ਅਰਾਮਦਾਰੀ ਨਾਲ ਜਾਇਆ ਜਾਵੇਗਾ ਠੀਕ ਹੈ ਟਾਇਮ 'ਤੇ ਪਹੁੰਚ ਜਾਂਗੇ ਇਸੇ ਲਈ ਪਹਿਲਾਂ ਬੁੱਕ ਕਰਵਾਈ ਹੈ ਤਾਂ ਪਲੀਜ਼ ਮੇਰੀ ਰਿਕੁਐਸਟ ਹੈਗੀ ਹੈ ਵੀ ਮੈਂ ਪਹੁੰਚਣਾ ਹੈਗਾ ਗਾ ਜਲਦੀ ਉੱਥੇ ਦੁਪਹਿਰ ਦੀ ਮੇਰੀ ਇੰਟਰਵਿਊ ਹੈਗੀ ਹੈ ਉਹ ਤੋਂ ਪਹਿਲਾਂ ਪਹਿਲਾਂ ਘੰਟਾ ਪਹਿਲਾਂ ਮੈਂ ਪਹੁੰਚ ਜਾ ਅਰਾਮ ਦੇ ਨਾਲ ਥੋੜ੍ਹਾ ਉੱਥੇ ਜਾ ਕੇ ਰਿਲੈਕਸ ਹੋ ਜਾ ਠੀਕ ਹੈ ਮੇਰੀ ਸੈਟਿੰਗ ਹੋ ਜਾਵੇ ਤਾਂ ਪਲੀਜ਼ ਕੋਸ਼ਿਸ਼ ਕਰੋ ਵੀ ਜਲਦੀ ਤੋਂ ਜਲਦੀ ਕੈਬ ਆ ਸਕੇ ਅਤੇ ਮੈਂ ਆਪਣਾ ਟਾਈਮ 'ਤੇ ਜਾ ਸਕਾਂ ਥੈਂਕ ਯੂ